ਅ ਸਾਡੇ ਖੇਤਰ ਵਿੱਚ ਟਰਾਂਸਪੋਰਟ ਸਹੂਲਤਾਂ ਹਨ ਕਾਫੀ ਜਿਵੇਂ ਬੱਸਾਂ ਹੋ ਗਈਆਂ ਜਿਹੜੀਆਂ ਸਰਕਾਰ ਵੱਲੋਂ ਚਲਾਈਆਂ ਹੋਈਆਂ ਨੇ ਇੱਕ ਪਿੰਡ ਤੋਂ ਦੂਜੇ ਪਿੰਡ ਜਾਣ ਲਈ ਵੀ ਬੱਸਾਂ ਨੇ ਅਤੇ ਸ਼ਹਿਰ ਦੇ ਵਿੱਚ ਜੇ ਇੱਕ ਜਗ੍ਹਾ ਤੋਂ ਦੂਜ ਦੂਜੀ ਜਗ੍ਹਾ 'ਤੇ ਜਾਣਾ ਉਹਦੇ ਲਈ ਵੀ ਬੱਸਾਂ ਨੇ ਬੱਸਾਂ ਕੁਝ ਪ੍ਰਾਈਵੇਟ ਵਾਲੀਆਂ ਵੀ ਹੈਗੀਆਂ ਨੇ ਅਤੇ ਕੁਝ ਉਹ ਬੱਸਾਂ ਵੀ ਨੇ ਜਿਹੜੀਆਂ ਸਰਕਾਰ ਨੇ ਚਲਾਈਆਂ ਨੇ ਬਾਕੀ ਜਿਵੇਂ ਔਟੋ ਰਿਕਸ਼ੇ ਹੋ ਗਏ ਉਹ ਵੀ ਨੇ ਪਰ ਅ ਅੱਜ ਕੱਲ੍ਹ ਜਿਵੇਂ ਬਿਜਲੀ ਵਾਲੇ ਔਟੋ ਰਿਕਸ਼ੇ ਵੀ ਚੱਲ ਪਏ ਤਾਂ ਉਹ ਵੀ ਨੇ ਉਹਦੇ ਕਰਕੇ ਫਿਰ ਜ਼ਿਆਦਾਤਰ ਲੋਕ ਬਿਜਲੀ ਵਾਲੇ 'ਚ ਸਫ਼ਰ ਕਰਦੇ ਨੇ ਕਿਉਂਕਿ ਉਹ ਸਸਤਾ ਪੈਂਦਾ ਅਤੇ ਬਾਕੀ ਜਿਹੜੇ ਸਾਈਕਲ ਵਾਲੇ ਰਿਕਸ਼ੇ ਹੁੰਦੇ ਸੀ ਉਹ ਵੀ ਹੈਗੇ ਨੇ ਅਤੇ ਜਿਹੜੇ ਲੋਕ ਜਿਹੜੇ ਆਪਣੀਆਂ ਲੋਕਾਂ ਦੀਆਂ ਨੇ ਜਿਵੇਂ ਸਕੂਟਰ ਹੋ ਗਏ ਮੋਟਰਸਾਈਕਲ ਹੋ ਗਏ ਜਾਂ ਸਾਈਕਲਾਂ ਹੋ ਗਈਆਂ ਜਾਂ ਜੇ ਲੰਬਾ ਸਫ਼ਰ ਹੈ ਤਾਂ ਗੱਡੀ 'ਚ ਵੀ ਬਹੁਤ ਲੋਕ ਜਾਂਦੇ ਨੇ ਤਾਂ ਟਰਾਂਸਪੋਰਟ ਦੇ ਜਿਹੜੇ ਸਹੂਲਤਾਂ ਨੇ ਉਹ ਕਾਫੀ ਨੇ ਪਰ ਇਹਦੇ ਨਾਲ ਫਿਰ ਸੜਕਾਂ 'ਤੇ ਟਰੈਫਿਕ ਵੀ ਮਾਮੂਲੀ ਜਿਹੀ ਗੱਲ ਹੈ ਵੱਧ ਜਾਂਦੀ ਹੈ ਅਤੇ ਬੱਸਾਂ 'ਚ ਆਉਣਾ ਜਾਣਾ ਵੀ ਸੌਖਾ ਹੈ ਕਿਉਂਕਿ ਜੇ ਲੰਬਾ ਸਫ਼ਰ ਹੈ ਇੱਕ ਪਿੰਡ ਤੋਂ ਦੂਜੇ ਪਿੰਡ ਜਾਣਾ ਹੈ ਤਾਂ ਐਵੇਂ ਟਰਾਂਸਪੋਰਟਰ ਸਾਈਕਲ ਬਣੇ ਹੋਏ ਨੇ ਕਿ ਤੁਸੀਂ ਇੱਕ ਬੱਸ ਫੜੋ ਤਾਂ ਇੱਕ ਜਗ੍ਹਾ 'ਤੇ ਪਹੁੰਚ ਜਾਓ ਫਿਰ ਉੱਥੋਂ ਉਤਰ ਕੇ ਤੁਹਾਨੂੰ ਦੂਜੀ ਬੱਸ ਵੀ ਸੌਖੀ ਮਿਲ ਜਾਂਦੀ ਹੈ